ਹਾਂਜੀ ਹਾਂਜੀ ਬਿਲਕੁਲ ਤੁਸੀਂ ਆਮ ਖਾਸ ਬਾਗ ਜਾ ਸਕਦੇ ਹੋ ਜਿਹੜਾ ਆਮ ਖਾਸ ਬਾਗ ਏ ਉਹ ਵੀ ਸਰਹਿੰਦ ਦੀ ਇਤਿਹਾਸਿਕ ਜਗ੍ਹਾ ਏ ਅਤੇ ਇਹਦੇ ਅੰਦਰ ਤੁਹਾਨੂੰ ਬਹੁਤ ਸਾਰੇ ਬਾਗ ਮਿਲ ਜਾਣਗੇ ਅਤੇ ਅਤੇ ਆਮ ਖਾਸ ਬਾਗ ਦੇ ਅੰਦਰ ਹੀ ਰੈਸਟੋਰੈਂਟ ਬਣਿਆ ਹੋਇਆ ਅਤੇ ਜੇ ਤੁਸੀਂ ਜਿਵੇਂ ਘੰਟਾ ਸਾਰੀ ਜਗ੍ਹਾ ਦੇਖ ਲਓ ਫਿਰ ਉਸ ਤੋਂ ਬਾਅਦ ਤੁਸੀਂ ਉੱਥੇ ਖਾਣਾ ਵੀ ਖਾ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣੇ ਕੋਲ ਰੋਜ਼ਾ ਸ਼ਰੀਫ ਹੈ ਅਤੇ ਜੇ ਤੁਸੀਂ ਜਿਵੇਂ ਆਮ ਖਾਸ ਬਾਗ ਤੋਂ ਥੋੜ੍ਹਾ ਜਿਹਾ ਹੀ ਦੂਰ ਜਾ ਕੇ ਹੈ ਤੁਸੀਂ ਚਾਹੇ ਫੋਰ ਵੀਲਰ ਕਾਰ ਦੇ ਨਾਲ ਚਲੇ ਜੋ ਚਾਹੇ ਤੁਸੀਂ ਸਕੂਟਰ ਦੇ ਓੱਤੇ ਜਾਂ ਐਕਟੀਵਾ 'ਤੇ ਓੱਤੇ ਚਲ ਜਾਓ ਤਾਂ ਉਹ 'ਤੇ ਤੁਹਾਨੂੰ ਬਹੁਤ ਜ਼ਿਆਦਾ ਦੂਰ ਨਹੀਂ ਪਏਗਾ ਤੁਸੀਂ ਉੱਥੇ ਵੀ ਜਾ ਸਕਦੇ ਹੋ ਅਤੇ ਫਿਰ ਉਸ ਤੋਂ ਬਾਅਦ ਆਪਣੇ ਕੋਲ ਫਲੋਟਿੰਗ ਰੈਸਟੋਰੈਂਟ ਵੀ ਹੈ ਉਹ ਸਰਹਿੰਦ ਤੋਂ ਥੋੜ੍ਹਾ ਜਿਹਾ ਬਾਹਰ ਜਾ ਕੇ ਹੈ ਪਰ ਉਹ ਵੀ ਜਗ੍ਹਾ ਬਹੁਤ ਵਧੀਆ ਬਣੀ ਹੋਈ ਹੈ ਅਤੇ ਉਹ ਐਕਚੁਲੀ ਇਵੇਂ ਹੈ ਜਿਵੇਂ ਰੀਵਰ ਦੇ ਉੱਪਰ ਹੀ ਉਹਨਾਂ ਨੇ ਰੈਸਟੋਰੈਂਟ ਬਣਾਇਆ ਹੋਇਆ ਅਤੇ ਉੱਥੇ ਵੀ ਬੜਾ ਵਧੀਆ ਖਾਣਾ ਮਿਲਦਾ ਅਤੇ ਉੱਥੇ ਜੇ ਤੁਸੀਂ ਸ਼ਾਮ ਦੇ ਟਾਈਮ ਜਾਂਦੇ ਹੋ ਤਾਂ ਫਿਰ ਤੁਸੀਂ ਉੱਥੇ ਪਿਕਚਰਸ ਕਲਿੱਕ ਕਰ ਸਕਦੇ ਹੋ ਉੱਥੇ ਬਹੁਤ ਸੋਹਣੀਆਂ ਫੋਟੋ ਆਉਂਦੀਆਂ ਨੇ ਉਸ ਟਾਈਮ ਦੇ ਵਿੱਚ ਹਾਂਜੀ ਬਜਟ ਤਾਂ ਤੁਹਾਨੂੰ ਜਿਹੜਾ ਚਾਹੀਦਾ ਉਹ ਸਿਰਫ ਜਿਵੇਂ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਉੱਥੇ ਤੁਹਾਨੂੰ ਲੋੜ ਪਏਗੀ ਨਹੀਂ ਤਾਂ ਜਿਵੇਂ ਜਿਹੜਾ ਆਮ ਖਾਸ ਬਾਗ ਹੈ ਜਾਂ ਰੋਜ਼ਾ ਸ਼ਰੀਫ ਹੈ ਉਹ ਤਾਂ ਤੁਸੀਂ ਬਿਨਾਂ ਕਿਸੇ ਪੈਸੇ ਤੋਂ ਵੀ ਜਾ ਸਕਦੇ ਹੋ ਅੰਦਰ ਉਹ ਫਰੀ ਆਫ ਐਂਟਰੀ ਹੈ ਅਤੇ ਜੇ ਤੁਹਾਡੇ ਕੋਲੇ ਜਿਵੇਂ ਪੂਰਾ ਇੱਕ ਦਿਨ ਹੈ ਤਾਂ ਫਿਰ ਤੁਸੀਂ ਆਪਣਾ ਪੂਰਾ ਇੱਕ ਦਿਨ ਜਿਵੇਂ ਉਹ ਲਗਾ ਲਉਂਗੇ ਤਾਂ ਫਿਰ ਉਹਦੇ ਅੰਦਰ ਵੀ ਤੁਹਾਡੀ ਸਾਰੀ ਜਗ੍ਹਾ ਕਵਰ ਹੋ ਜਾਏਗੀ ਜਿਵੇਂ ਜੇ ਤੁਸੀਂ ਸਵੇਰੇ ਆਮ ਖਾਸ ਬਾਗ ਚਲੇ ਗਏ ਉੱਥੇ ਵਧੀਆ ਸਵੇਰੇ ਹਵਾ ਹੋਏਗੀ ਫੁੱਲ ਵਗੈਰਾ ਨੇ ਉੱਥੇ ਉੱਥੇ ਜਿਵੇਂ ਨੌ ਕੁ ਵਜੇ ਚਲੇ ਗਏ ਅਤੇ ਉਸ ਤੋਂ ਬਾਅਦ ਜਿਵੇਂ ਘੰਟਾ ਦੋ ਘੰਟਾ ਘੁੰਮ ਕੇ ਆਪਣਾ ਸੈਰ ਵਗੈਰਾ ਕਰਕੇ ਉਸ ਤੋਂ ਬਾਅਦ ਤੁਸੀਂ ਖਾਣਾ ਖਾ ਲਓ ਉੱਥੋਂ ਦੀ ਫਿਰ ਖਾਣਾ ਖਾ ਕੇ ਤੁਸੀਂ ਰੋਜ਼ਾ ਸ਼ਰੀਫ ਵਾਲੀ ਸਾਈਡ ਚਲੇ ਜਾਓ ਰੋਜ਼ਾ ਸ਼ਰੀਫ ਜਾਂਦੇ ਜਾਂਦੇ ਹੀ ਤੁਹਾਨੂੰ ਫਤਹਿਗੜ੍ਹ ਸਾਹਿਬ ਗੁਰਦੁਆਰਾ ਦੇ ਦਰਸ਼ਨ ਹੋ ਜਾਣਗੇ ਅਤੇ ਉਸ ਤੋਂ ਬਾਅਦ ਤੁਸੀਂ ਰੋਜ਼ਾ ਸ਼ਰੀਫ ਚਲੇ ਜਾਓ ਅਤੇ ਜੇ ਤੁਸੀਂ ਹਵੇਲੀ ਦੇਖਣੀ ਹੈ ਤਾਂ ਇੱਕ ਟੋਡਰ ਮੱਲ ਹਵੇਲੀ ਆ ਉਹ ਵੀ ਬੜੀ ਅੱਛੀ ਬਣੀ ਹੋਈ ਹੈ ਅਤੇ ਉਹ ਪੰਜਾਬ ਸਰਕਾਰ ਨੇ ਹੁਣੇ ਰੀਸਟੋਰ ਕੀਤੀ ਹੈ ਅਤੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਉਹ ਵੀ ਬੜੀ ਅੱਛੀ ਜਗ੍ਹਾ ਹੈ ਉਸ ਉੱਥੇ ਜਾਣ ਤੋਂ ਬਾਅਦ ਫਿਰ ਤੁਸੀਂ ਸਰਹਿੰਦ ਤੋਂ ਜਿਵੇਂ ਥੋੜ੍ਹਾ ਜਿਹਾ ਬਾਹਰ ਨਿਕਲ ਜਾਓਂਗੇ ਤਾਂ ਤੁਹਾਨੂੰ ਫਲੋਟਿੰਗ ਰੈਸਟੋਰੈਂਟ ਮਿਲ ਜਾਏਗਾ ਫਿਰ ਤੁਸੀਂ ਵੀ ਆਪਣਾ ਸ਼ਾਮ ਦਾ ਖਾਣਾ ਉੱਥੇ ਖਾ ਲਿਆ ਜਾਂ ਰਾਤ ਨੂੰ ਡਿਨਰ ਉੱਥੇ ਕਰ ਲਿਆ ਤਾਂ ਮਤਲਬ ਤੁਹਾਨੂੰ ਸਿਰਫ ਇੱਕ ਦਿਨ ਦੇ ਅੰਦਰ ਹੀ ਤੁਸੀਂ ਸਾਰੀ ਜਗ੍ਹਾ ਕਵਰ ਕਰ ਲਓਂਗੇ ਬੜੇ ਆਰਾਮ ਨਾਲ ਤੁਸੀਂ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਕਿਉਂਕਿ ਜੇ ਤਾਂ ਤੁਸੀਂ ਫੈਮਲੀ ਦੇ ਨਾਲ ਆ ਰਹੇ ਹੋ ਫਿਰ ਉਹ ਚੀਜ਼ ਥੋੜ੍ਹੀ ਅਲੱਗ ਹੋ ਜਾਏਗੀ ਜੇ ਜੇ ਤੁਸੀਂ ਇਕੱਲੇ ਬੰਦੇ ਨੇ ਆਣਾ ਉਹ ਚੀਜ਼ ਅਲੱਗ ਹੋਏਗੀ ਕਿਉਂਕਿ ਅਸੀਂ ਨਾਲ ਨਾਲ ਟਰਾਂਸਪੋਰਟੇਸ਼ਨ ਵੀ ਪ੍ਰੋਵਾਈਡ ਕਰ ਦਿੰਦੇ ਹਾਂ ਜਿਵੇਂ ਜੇ ਤੁਹਾਨੂੰ ਕਾਰ ਚਾਹੀਦੀ ਆ ਤਾਂ ਉਹ ਵੀ ਅਸੀਂ ਦਿਨ ਦੇ ਹਿਸਾਬ ਨਾਲ ਤੁਹਾਨੂੰ ਰੈਂਟ ਕਰ ਦਾਂਗੇ ਜੇ ਤੁਹਾਨੂੰ ਟੂ ਵੀਲਰ ਚਾਹੀਦਾ ਤਾਂ ਅਸੀਂ ਤੁਹਾਨੂੰ ਉਹ ਵੀ ਰੈਂਟ ਕਰ ਸਕਦੇ ਆ ਅਤੇ ਜਿਵੇਂ ਤੁਸੀਂ ਸਾਨੂੰ ਕਨਫਰਮ ਕਰੋਗੇ ਵੀ ਕਿੰਨੇ ਕੁ ਜਾਣੇ ਆ ਰਹੇ ਆ ਫਿਰ ਅਸੀਂ ਉਸ ਹਿਸਾਬ ਨਾਲ ਰੇਂਜ ਕਰਕੇ ਤੁਹਾਨੂੰ ਪ੍ਰਾਈਜ ਦੱਸ ਦਾਂਗੇ ਹਾਂਜੀ ਓਕੇ ਓਕੇ